ਸਰਕਾਰ ਵੱਲੋਂ ਪੰਜਾਬ ਵਿੱਚ ਸਿਹਤ ਸੰਭਾਲ ਦੀ ਸਮੁੱਚੀ ਸਥਿਤੀ ਅੱਗੇ ਨਾਲੋਂ ਬਹੁਤ ਹੀ ਚੰਗੀ ਹੈ ਅਸੀਂ ਅਗਰ ਕਿਸੇ ਆਪਣੇ ਇਲਾਕੇ ਵਿੱਚ ਹਸਪਤਾਲ ਜਾਂ ਕਲੀਨਿਕ ਲੱਭਣੇ ਹਨ ਅਤੇ ਸਾਨੂੰ ਉਸ ਬਾਰੇ ਪੂਰੀ ਜਾਣਕਾਰੀ ਹੈਗੀ ਹੈ ਉਸ ਦੇ ਬਾਰੇ ਅਸੀਂ ਗੂਗਲ 'ਤੇ ਲੱਭ ਸਕਦੇ ਹਾਂ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਮੁਨਾਦੀ ਕੀਤੀ ਜਾਂਦੀ ਹੈ ਜਾਂ ਇਹਦੇ ਪੈਂਪਲਟਸ ਵੀ ਵੰਡੇ ਜਾਂਦੇ ਹਨ ਆਸ਼ਾ ਵਰਕਰਸ ਜਾਂ ਡਾਕਟਰਸ ਦੀ ਟੀਮ ਵੀ ਹਰ ਵੇਲੇ ਸਾਡੇ ਆਸ ਪਾਸ ਹੀ ਰਹਿੰਦੀ ਹੈ ਕਿਉਂਕਿ ਇਹ ਸਾਡੇ ਇੱਕ ਦਾਇਰੇ ਦੇ ਵਿੱਚ ਆਉਂਦਾ ਹਰ ਦਾਇਰੇ ਦੇ ਵਿੱਚ ਤੁਹਾਨੂੰ ਛੋਟੇ ਮੋਟੇ ਜਿਹੜੇ ਹਸਪਤਾਲ ਆ ਉਹ ਦੇਖਣ ਨੂੰ ਮਿਲ ਜਾਂਦੇ ਹਨ ਜਿਵੇਂ ਕਿ ਹੁਣੇ ਨਵੇਂ ਹੀ ਸਾਡੇ ਜਿਹੜਾ ਹਸਪਤਾਲ ਕਲੀਨਿਕ ਖੁੱਲ੍ਹੇ ਹਨ ਅਤੇ ਉਹਨਾਂ ਵਿੱਚ ਵੀ ਆਮ ਆਦਮੀ ਜਾ ਸਕਦਾ ਜਿਸ ਨੂੰ ਆਮ ਆਦਮੀ ਕਲੀਨਿਕ ਵੀ ਕਹਿੰਦੇ ਹਨ ਆਮ ਆਦਮੀ ਦੀ ਪਹੁੰਚ ਦੇ ਬਿਲੁਕਲ ਹੀ ਕੋਲ ਹੈਗਾ ਉਹਨੂੰ ਕਿਤੇ ਦੂਰ ਭੱਜਣਾ ਨਹੀਂ ਪੈਂਦਾ